ਹੱਥ ਨਾਲ ਬਣਾਏ ਦੇ ਰੈਡੀਮੇਡ ਕੱਪੜੇ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ ਹੈ ਹੱਥ ਨਾਲ ਕੱਪੜੇ ਬਹੁਤ ਰੀਝ ਨਾਲ ਬਣਾਏ ਜਾਂਦੇ ਹਨ ਜਿਹੜੇ ਰੈਡੀਮੇਡ ਕੱਪੜੇ ਆ ਉਹਨਾਂ ਦੀਆਂ ਸੀਨਾ ਕੱਚੀਆਂ ਹੁੰਦੀਆਂ ਹਨ ਮੋਟਾਂ ਵਖਾ ਕਰਕੇ ਲਾਈਆਂ ਹੋਈਆਂ ਹੁੰਦੀਆਂ ਹਨ ਹੱਥ ਨਾਲ ਕੱਪੜੇ ਬਣਾਏ ਬਹੁਤ ਟਾਈਮ ਤੱਕ ਚਲਦੇ ਹਨ ਰੈਡੀਮੇਟ ਕੱਪੜੇ ਇੰਨਾਂ ਟਾਈਮ ਨਹੀਂ ਚੱਲਦੇ ਉਹਨਾਂ ਦੀਆਂ ਸਿਉਣ ਢਿੱਲੀਆਂ ਫਿਰ ਸਾਨੂੰ ਹੱਥ ਨਾਲ ਹੀ ਲਗਾਉਣੀਆਂ ਪੈਂਦੀਆਂ ਹਨ ਮਾਰਕੀਟ 'ਚ ਇਹਨਾਂ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਇਸ ਮੁਤਾਬਕ ਪਿੰਡਾਂ ਵਿੱਚ ਦੁਕਾਨਾਂ ਰੈਡੀਮੇਡ ਕੱਪੜੇ ਦੀਆਂ ਘੱਟ ਹੁੰਦੀਆਂ ਹਨ ਹੱਥ ਨਾਲ ਕੱਪੜੇ ਸੀਤੇ ਦੀਆਂ ਦੁਕਾਨਾਂ ਵੀ ਬਹੁਤ ਘੱਟ ਹੁੰਦੀਆਂ ਹਨ ਪਰ ਜ਼ਿਆਦਾਤਰ ਲੋਕ ਹੱਥ ਨਾਲ ਕੱਪੜੇ ਸੀਤੇ ਹੀ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਇਹ ਜ਼ਿਆਦਾ ਟਾਈਮ ਤੱਕ ਚੱਲਦੇ ਹਨ ਰੈਡੀਮੇਡ ਕੱਪੜੇ ਘੱਟ ਟਾਈਮ ਤੱਕ ਚਲਦੇ ਹਨ